ਹਾਂਜੀ ਜੇ ਮੈਂ ਆਪਦੀ ਮਨਪਸੰਦ ਫੋਟੋ ਦੀ ਗੱਲ ਕੀਤੀ ਜਾਵਾਂ ਜੋ ਮੇਰੇ ਦੁਆਰਾ ਖਿੱਚੀ ਗਈ ਸੀ ਤਾਂ ਮੈਂ ਦੋ ਸਾਲ ਪਹਿਲਾਂ ਮੇਰਾ ਨਾ ਇੱਕ ਭਾਣਜਾ ਹੈ ਛੋਟਾ ਅਤੇ ਉਹਦੀ ਉਹ ਉਦੋਂ ਉਮਰ ਉਹਦੀ ਦੋ ਕੁ ਸਾਲਾਂ ਦੀ ਸੀ ਅਤੇ ਉਹ ਨਹਾ ਰਿਹਾ ਸੀ ਅਤੇ ਨਾਲ ਚੌੜ ਵੀ ਕਰ ਰਿਹਾ ਸੀ ਬੱਠਲ ਦੇ ਵਿੱਚ ਬੈਠਾ ਸੀ ਜੋ ਘਰਾਂ ਦੇ ਵਿੱਚ ਬੱਠਲ ਹੁੰਦੇ ਨੇ ਅਤੇ ਪਾਣੀ ਵਿੱਚ ਨਹਾ ਰਿਹਾ ਸੀ ਅਤੇ ਥੱਲੇ ਹੱਥ ਮਾਰ ਰਿਹਾ ਸੀ ਜ਼ੋਰ ਜ਼ੋਰ ਨਾਲ ਪਾਣੀ ਦੇ ਵਿੱਚ ਅਤੇ ਪਾਣੀ ਉੱਪਰ ਉੱਛ ਉੱਪਰ ਉੱਠ ਰਿਹਾ ਸੀ ਅਤੇ ਮੇਰੇ ਕੋਲ ਉਦੋਂ ਫੋਨ ਹੁੰਦਾ ਸੀ ਆਈਫੋਨ ਆਈਫੋਨ ਸੀ ਮੇਰੇ ਕੋਲ ਅਤੇ ਉਦੋਂ ਮੈਂ ਉਹਦੇ 'ਚ ਫੋਟੋ ਖਿੱਚੀ ਸੀ ਉਹਦੀ ਆਪਣਾ ਰੀਅਰ ਕੈਮਰੇ ਤੋਂ ਬਹੁਤ ਸੋਹਣੀ ਫੋਟੋ ਆਈ ਉਹ ਅਤੇ ਬਿਲਕੁਲ ਰੈਂਡਮ ਕਲੈਕਟ ਰੈਂਡਮ ਕਲੈਕਟ ਕੀਤੀ ਸੀ ਫੋਟੋ ਅਤੇ ਉਹਦੇ ਵਿੱਚ ਪਾਣੀ ਦੇ ਛਿੱਟੇ ਉੱਪਰ ਅਤੇ ਉਹਦੀ ਹਾਸੀ ਉਹਦੇ ਫੇਸ ਦੇ ਐਕਸਪਰੈਸ਼ਨ ਅਤੇ ਬਹੁਤ ਹੀ ਸੋਹਣੀ ਫੋਟੋ ਆਈ ਸੀ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਮੈਨੂੰ ਲੱਗਦਾ ਫੋਟੋਗਰਾਫੀ ਸੀ ਜਿਹਦੇ ਵਿੱਚ ਸਭ ਤੋਂ ਵਧੀਆ ਫੋਟੋ ਕਲੈਕਟ ਕੀਤੀ ਮੈਂ ਉਹ ਮੇਰੇ ਭਾਣਜੇ ਦੀ